ਜੇਕਰ ਅਸੀਂ ਪੰਜ ਸਾਲ ਪਹਿਲਾਂ ਤਾਂ ਹੁਣ ਭਾਰਤ ਦੀ ਡਿਵੈਲਪਮੈਂਟ ਦੀ ਤੁਲਨਾ ਕਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਭਾਰਤ ਵਿੱਚ ਬਹੁਤ ਹੀ ਜ਼ਿਆਦਾ ਹੁਣ ਅੰਤਰ ਹੋ ਚੁੱਕਾ ਹੈ ਜਿਵੇਂ ਸਾਡਾ ਭਾਰਤ ਬਹੁਤ ਡਿਵੈਲਪ ਹੋ ਚੁੱਕਾ ਹੈ ਅਤੇ ਇਸ 'ਤੇ ਬਹੁਤ ਸਾਰੇ ਟੈਕਨੋਲਜ਼ੀਸ ਵੀ ਆ ਸਕਦੀਆਂ ਹਨ ਜੇ ਜੇ ਅਸੀਂ ਉਦਯੋਗਾਂ ਵੱਲ ਦੇਖੀਏ ਤਾਂ ਅਸੀਂ ਖੇਤੀਬਾੜੀ ਉਦਯੋ ਉਦਯੋਗ ਦੀ ਇਗਜ਼ੈਪਲ ਦੇ ਸਕਦੇ ਹਾਂ ਜਾਂ ਅਸੀਂ ਕੱਪੜਾ ਉਦਯੋਗ ਦੀ ਇਗਜ਼ਾਪਲ ਲੈ ਸਕਦੇ ਹਾਂ ਜੇਕਰ ਅਸੀਂ ਬੈਂਕਿੰਗ ਵਗੈਰਾ ਵੱਲ ਦੇਖੀਏ ਤਾਂ ਅਸੀਂ ਪਹਿਲਾਂ ਪੇਮੈਂਟ ਕਰਨ ਲਈ ਬੈਂਕਾਂ ਵਿੱਚ ਜਾਂਦੇ ਸੀ ਜਾਂ ਪੇਮੈਂਟ ਕਿਸੇ ਨੂੰ ਕਰਵਾਉਣ ਲਈ ਹੁਣ ਅਸੀਂ ਆਪਣੇ ਫੋਨ ਵਿੱਚ ਹੀ ਬਹੁਤ ਆਸਾਨ ਤਰੀਕੇ ਨਾਲ ਗੂਗਲ ਪੇ ਜਾਂ ਪੇਟੀਐੱਮ ਦੀ ਹੈਲਪ ਨਾਲ ਇੱਕ ਦੂਜੇ ਨੂੰ ਪੇਮੈਂਟ ਕਰ ਵੀ ਸਕਦੇ ਹਾਂ ਅਤੇ ਕਰਵਾ ਵੀ ਸਕਦੇ ਹਾਂ ਜਿਸ ਨਾਲ ਪਤਾ ਲੱਗਦਾ ਹੈ ਕਿ ਸਾਡਾ ਭਾਰਤ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕਿਆ ਹੈ ਇਸ ਨਾਲ ਬਹੁਤ ਸਾਰੇ ਟਕਨੋਲਜੀਆਂ ਕਾਰਨ ਡਿਵੈਲਪਮੈਂਟ ਬਹੁਤ ਜ਼ਿਆਦਾ ਵੱਧ ਚੁੱਕੀ ਹੈ